ਪੰਜਾਬੀ ਭਾਸ਼ਾ ਪੰਜਾਬ ਵਿੱਚ ਬੋਲਣ ਵਾਲੀ ਭਾਸ਼ਾ ਹੈ ਦੂਸਰੀਆਂ ਸਟੇਟਾਂ ਵਿੱਚ ਇਹਨੂੰ ਬਹੁਤ ਘੱਟ ਲੋਕ ਸਮਝਦੇ ਹਨ ਸਾਨੂੰ ਪੰਜਾਬੀ ਵਿੱਚ ਗੱਲ ਕਰਨੀ ਵਿੱਚ ਬਹੁਤ ਔਖੀ ਹੈ ਕਿਉਂਕਿ ਉਹ ਲੋਕ ਪੰਜਾਬੀ ਭਾਸ਼ਾ ਨੂੰ ਨਹੀਂ ਸਮਝਦੇ ਪੰਜਾਬ ਵਿੱਚ ਹੀ ਪੰਜਾਬੀ ਚਲਦੀ ਹੈ ਅਤੇ ਦੂਜੀਆਂ ਸਟੇਟਾਂ ਵਿੱਚ ਸਾਨੂੰ ਬੜੀ ਦਿੱਕਤ ਆਉਂਦੀ ਹੈ ਗੱਲ ਕਰਨ ਵਿੱਚ ਕਿਉਂਕਿ ਸਾ ਇੱਥੇ ਸਾਡੀ ਪੰਜਾਬੀ ਲਾਜ਼ਮੀ ਹੈ ਜਦੋਂ ਅਸੀਂ ਦੂਜੀਆਂ ਸਟੇਟਾਂ ਵਿੱਚ ਜਾਂਦੇ ਹਾਂ ਤਾਂ ਸਾਨੂੰ ਹਿੰਦੀ ਜਾਂ ਇੰਗਲਿਸ਼ ਵਿੱਚ ਗੱਲ ਕਰਨੀ ਹੁੰਦੀ ਹੈ ਉਹਦੇ ਵਿੱਚ ਸਾਨੂੰ ਦਿੱਕਤ ਆਉਂਦੀ ਆ ਅਤੇ ਪੰਜਾਬੀ ਭਾਸ਼ਾ ਇਸ ਕਰਕੇ ਪਿੱਛੇ ਰਹਿ ਰਹੀ ਹੈ ਕਿਉਂਕਿ ਅੱਜ ਕੱਲ੍ਹ ਦੀ ਪੰਜਾਬ ਦੇ ਲੋਕ ਦੂਜਾ ਇੰਗਲਿਸ਼ ਮੀਡੀਅਮ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਆ ਅਤੇ ਉਹ ਜ਼ਿਆਦਾ ਜਿਹੜੇ ਪ੍ਰਾਈਵੇਟ ਸਕੂਲ ਆ ਉਹ ਇੰਗਲਿਸ਼ ਨੂੰ ਜਾਂ ਹਿੰਦੀ ਨੂੰ ਜ਼ਿਆਦਾ ਰੈਫਰੈਂਸ ਦਿੰਦੇ ਆ ਅਤੇ ਪੰਜਾਬੀ ਉੱਥੇ ਘੱਟ ਪੜ੍ਹਾਉਂਦੇ ਆ ਅਤੇ ਇਸ ਕਰਕੇ ਪੰਜਾਬੀ ਭਾਸ਼ਾ ਪਿੱਛੇ ਜਾ ਰਹੀ ਹੈ ਸਾਨੂੰ ਪੰਜਾਬੀ ਬਾਕੀ ਸਟੇਟਾਂ ਵਿੱਚ ਵੀ ਹੋਣੀ ਲਾਜ਼ਮੀ ਹੈ ਕਿਉਂਕਿ ਬਾਕੀ ਬ ਬਾਕੀ ਸਟੇਟਾਂ ਦੇ ਬੱਚੇ ਬ ਬੱਚੇ ਜਾਂ ਕੋਈ ਵੀ ਇਨਸਾਨ ਪੰਜਾਬੀ ਭਾਸ਼ਾ ਨੂੰ ਸਮਝੇ ਅਤੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਲੋਕ ਪੂਰੀ ਪ੍ਰੋਪਰ ਲਾਜ਼ਮੀ ਕੀਤੀ ਜਾਵੇ ਗੌਰਮੈਂਟ ਨੂੰ ਚਾਹੀਦਾ ਵੀ ਪ੍ਰੋਪਰ ਹਰੇਕ ਸਕੂਲ ਨੂੰ ਪੰਜਾਬੀ ਭਾਸ਼ਾ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬੀ ਭਾਸ਼ਾ ਵਿੱਚ ਕਾਫੀ ਦਿੱਕਤਾਂ ਰਹੀਆਂ ਕਿਉਂਕਿ ਜਿਹੜੇ ਅੱਜ ਕੱਲ੍ਹ ਫਾਰਮ ਆਉਂਦੇ ਆ ਉਹ ਵੀ ਇੰਗਲਿਸ਼ ਵਿੱਚ ਆਉਣ ਲੱਗ ਗਏ ਜਾਂ ਕੋਈ ਪੋਸਟ ਭਰਦੇ ਉਹ ਵੀ ਇੰਗਲਿਸ਼ ਆਉਂਦੀ ਆ ਅਤੇ ਗੌਰਮੈਂਟ ਨੂੰ ਚਾਹੀਦਾ ਵੀ ਇਹ ਵੀ ਜੋ ਫਾਰਮ ਆ ਪੰਜਾਬੀ ਵਿੱਚ ਹੋਣੇ ਚਾਹੀਦੇ ਆ ਅਤੇ ਜੋ ਬੰਦਾ ਕੋਈ ਵੀ ਪੰਜਾਬ ਦੀ ਨੌਕਰੀ ਹਾਸਿਲ ਕਰੇਗਾ ਤਾਂ ਉਹ ਵੀ ਪੰਜਾਬੀ ਵਿੱਚ ਹੀ ਕੁਸ਼ਚਨ ਆਨਸਰ ਆਉਣੇ ਚਾਹੀਦੇ ਹਨ